ਪੰਦਰਾਂ ਤਿੰਨ ਸੌ ਪੰਜਾਹ ਛੇ ਹਜ਼ਾਰ ਪੰਜ ਸੌ ਵੀਹ ਪੰਜਾਹ ਹਜ਼ਾਰ ਛੇ ਸੌ ਅਠਾਈ ਨੌਂ ਲੱਖ ਛਪੰਜਾ ਹਜ਼ਾਰ ਤਿੰਨ ਸੌ ਅੱਸੀ